ਪੰਜਾਬ ਵਿੱਚ ਕਾਰੋਬਾਰੀ ਖੇਤਰ ਉਭਾਰ ਰਹੀਆਂ ਤਕਨੀਕਾਂ ਜੋ ਕਿ ਅੱਜ ਕੱਲ੍ਹ ਮਸ਼ੀਨੀ ਯੁੱਗ ਬਣ ਚੁੱਕੀਆਂ ਹਨ ਜਿਵੇਂ ਕਿਸੇ ਚੀਜ਼ ਨੂੰ ਆਪਾਂ ਡਿਜੀਟਲ ਕਰ ਦਿੰਦੇ ਹਾਂ ਵਪਾਰ ਖੇਤਰ ਵਿੱਚ ਪਰਮੋ ਆਪਣੀ ਮਸ਼ਹੂਰੀ ਵਾਸਤੇ ਇੰਸਟਾਗਰਾਮ ਫੇਸਬੁੱਕ ਜਾਂ ਵਟਸਅੱਪ 'ਤੇ ਲਿੰਕ ਕਰ ਸਕਦੇ ਹਾਂ ਜਿਸ ਨਾਲ ਬਿਜਨਸ ਵਧੀਆ ਤਰੀਕੇ ਨਾਲ ਚੱਲ ਸਕਦਾ ਹੈ ਉਸ ਤੋਂ ਇਲਾਵਾ ਹੋਰ ਵੀ ਤਕਨੀਕਾਂ ਹਨ ਜਿਹਨਾਂ ਦਾ ਜਿਹਨਾਂ ਰਾਹੀਂ ਆਪਣਾ ਬਿਜਨਸ ਅੱਗੇ ਲਿਜਾ ਸਕਦੇ ਹਾਂ ਵੀ ਫਾਸਟ ਟਰੈਕ ਜਿਹੜੀਆਂ ਆਉਂਦੀਆਂ ਹਨ ਪੇਮੈਂਟਸ ਵਗੈਰਾ ਜਲਦੀ ਪੇਮੈਂਟ ਪਹੁੰਚ ਜਾਂਦੀ ਹੈ ਆਨਲਾਈਨ ਕਰਕੇ ਬੈਂਕ ਟੂ ਬੈਂਕ ਜਾਂ ਫੋਨਪੇ ਵਗੈਰਾ ਤੋਂ ਆਪਾਂ ਫੋਨ ਯੂਜ ਕਰਕੇ ਇੱਥੋਂ ਡਾਇਰੈਕਟ ਹੀ ਆਪਣੇ ਕੋਂਟੈਕਟ ਕਰ ਸਕਦੇ ਹਾਂ ਆਪਣੇ ਕਸਟਮਰ ਨੂੰ ਕਸਟਮਰ ਆਪਣੇ ਕਸਟਮਰ ਨੂੰ ਕਸਟਮਰ ਦੇ ਨਾਲ ਸਿੱਧੀ ਪੇਮੈਂਟ ਕਰ ਸਕਦੇ ਹਾਂ ਅਤੇ ਉਸ ਤੋਂ ਇਲਾਵਾ ਸਾਡਾ ਡਾਟਾ ਵੀ ਸੇਫ ਰਹਿੰਦਾ ਹੈ ਬੈਂਕਾਂ ਵਿੱਚ ਬੈਂਕਾਂ ਵਿੱਚ ਲੈਣ ਦੇਣ ਵਾਸਤੇ ਲੰਬੀਆਂ ਲਾਈਨਾਂ ਵਿੱਚ ਨਹੀਂ ਖੜਨਾ ਪੈਂਦਾ ਟਾਈਮ ਸਮੇਂ ਦੀ ਬੱਚਤ ਹੁੰਦੀ ਹੈ ਨਾ ਲਾਈਨਾਂ 'ਤੇ ਲੱਗੋ ਜਿਵੇਂ ਕਿ ਟਿਕਟ ਬੁੱਕ ਕਰਵਾਉਣੀ ਹੋਵੇ ਰੇਲਵੇ ਦੀ ਟਿਕਟ ਬੁੱਕ ਕਰਵਾਉਣੀ ਹੋਵੇ ਤਾਂ ਅਸੀਂ ਆਨਲਾਈਨ ਹੀ ਕਰ ਸਕਦੇ ਹਾਂ ਜਿਹਦੇ ਨਾਲ ਟਾਈਮ ਬੱਚ ਜਾਂਦਾ ਹੈ ਸਮਾਂ ਬੱਚ ਜਾਂਦਾ ਹੈ ਸਮੇਂ ਦੀ ਬੱਚਤ ਹੁੰਦੀ ਹੈ ਉਹੀ ਆਪਣੇ ਵਪਾਰਕ ਖੇਤਰ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਮਾਂ ਦੇ ਸਕਦੇ ਹਾਂ ਇਸ ਤੋਂ ਇਲਾਵਾ ਜਿਵੇਂ ਨਕਲੀ ਨੋਟਾਂ ਦਾ ਵੀ ਇੱਧਰ ਉੱਧਰ ਹੋ ਜਾਂਦਾ ਹੈ ਇਸ ਤੋਂ ਵੀ ਬਚਿਆ ਜਾ ਸਕਦਾ ਹੈ